ਜਿਵੇਂ ਕਿ ਸਰੀਰ ਦੇ ਵਿਕਾਸ ਲਈ ਤੰਦਰੁਸਤੀ ਲਈ ਖੇਡਾਂ ਜ਼ਰੂਰੀ ਨੇ ਉਸ ਤਰ੍ਹਾਂ ਹੀ ਕਸਰਤ ਜ਼ਰੂਰੀ ਹੈ ਉਸ ਤਰ੍ਹਾਂ ਹੀ ਦਿਮਾਗੀ ਵਿਕਾਸ ਲਈ ਸਾਨੂੰ ਧਿਆਨ ਕਰਨਾ ਵੀ ਬਹੁਤ ਜ਼ਰੂਰੀ ਹੈ ਧਿਆਨ ਕਰਨ ਦੇ ਨਾਲ ਅਸੀਂ ਸਾਰੇ ਪਾਸਿਓਂ ਟੁੱਟ ਜਾਂਦੇ ਹਾਂ ਅਤੇ ਸਿਰਫ਼ ਸਾਡਾ ਧਿਆਨ ਜਿਹੜਾ ਉਹ ਆਪਣੇ ਜ਼ਮੀਰ ਨਾਲ ਆਪਣੇ ਦਿਲ ਨਾਲ ਜੁੜ ਜਾਂਦਾ ਹੈ ਜਿਹਦੇ ਨਾਲ ਅਸੀਂ ਸਾਰੀਆਂ ਪਰੇਸ਼ਾਨੀਆਂ ਤੋਂ ਹੱਟ ਕੇ ਆਪਣੇ ਸਰੀਰ ਵੱਲ ਨੂੰ ਆ ਜਾਂਦੇ ਹਾਂ ਸਭ ਤੋਂ ਜ਼ਿਆਦਾ ਵਧੀਆ ਜੋ ਸਾਨੂੰ ਸਭ ਤੋਂ ਜ਼ਿਆਦਾ ਵਧੀਆ ਆਰਾਮ ਦਿੰਦੀ ਹੈ ਉਹ ਹੈ ਜੀ ਸਾਡੀ ਪ੍ਰਾਣਾਯਾਮ ਦੀ ਆਦਤ ਬਰੀਦਿੰਗ ਐਕਸਰਸਾਈਜ ਜਿਹਨੂੰ ਕਹਿੰਦੇ ਨੇ ਲੰਬੇ ਲੰਬੇ ਸਾਹ ਲੈਣ ਨਾਲ ਕਿਸੇ ਪਾਰਕ 'ਚ ਬਹਿ ਕੇ ਕਿਸੇ ਖੁੱਲ੍ਹੀ ਜਗ੍ਹਾ 'ਤੇ ਬਹਿ ਕੇ ਲੰਬੇ ਲੰਬੇ ਸਾਹ ਲੈਣ ਦੇ ਨਾਲ ਸਾਡੇ ਸਰੀਰ ਦੇ ਅੰਦਰ ਜਿਹੜੀ ਔਕਸੀਜਨ ਦੀ ਮਾਤਰਾ ਉਹ ਪੂਰੀ ਹੁੰਦੀ ਹੈ ਔਕਸੀਜਨ ਪੂਰੀ ਹੋਣ ਦੇ ਨਾਲ ਸਾਡਾ ਸਰੀਰ ਐਨ ਤੰਦਰੁਸਤ ਰਹਿੰਦਾ ਹੈ ਤੰਦਰੁਸਤ ਰਹਿਣ ਦੇ ਨਾਲ ਅਸੀਂ ਦਿਮਾਗੀ ਸਰੀਰਕ ਪੱਖੋਂ ਦਿਮਾਗ ਪੱਖੋਂ ਹਰ ਪਾਸਿਓ ਅਸੀਂ ਬਿਲਕੁਲ ਨੋਰਮਲ ਹੋ ਜਾਂਦੇ ਹਾਂ ਜਦੋਂ ਸਾਰਾ ਕੁਛ ਸਾਡਾ ਨੋਰਮਲ ਚੱਲ ਰਿਹਾ ਹੁੰਦਾ ਤਾਂ ਸਾਡਾ ਸਰੀਰ ਆਪਣੇ ਆਪ ਹੀ ਨੋਰਮਲ ਹੋ ਜਾਂਦਾ ਹੈ ਬਰੀਦਿੰਗ ਐਕਸਰਸਾਈਜ ਜਿਹੜੀ ਆ ਉਹ ਦਰੱਖਤਾਂ ਦੇ ਥੱਲੇ ਬਹਿ ਕੇ ਕਰੋ ਅਤੇ ਹੋਰ ਜ਼ਿਆਦਾ ਵਧੀਆ ਹੈ ਕਿਉਂਕਿ ਉਹਦੇ ਨਾਲ ਔਕਸੀਜਨ ਸਾਡੀ ਕੰਪਲੀਟ ਹੋ ਜਾਂਦੀ ਹੈ ਅਤੇ ਅਸੀਂ ਆਪਣੇ ਆਪ 'ਚ ਬੜਾ ਫਰੈਸ਼ ਫੀਲ ਕਰਦੇ ਹਾਂ ਬੜਾ ਤੰਦਰੁਸਤ ਫੀਲ ਕਰਦੇ ਹਾਂ ਜਦੋਂ ਸਵੇਰੇ ਸਵੇਰੇ ਉੱਠ ਕੇ ਜਦੋਂ ਆਸ ਪਾਸ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਕੋਈ ਆਵਾਜ਼ ਨਹੀਂ ਹੁੰਦੀ ਕੋਈ ਸ਼ੋਰ ਸ਼ਰਾਬਾ ਨਹੀਂ ਹੁੰਦਾ ਕੋਈ ਸਕੂਟਰ ਗੱਡੀਆਂ ਦੇ ਰੌਲਾ ਨਹੀਂ ਹੁੰਦਾ ਉਸ ਵੇਲੇ ਅਸੀਂ ਜਦੋਂ ਖੁੱਲ੍ਹੇ ਦੇ ਵਿੱਚ ਬਹਿ ਕੇ ਆਪਣੀ ਡੂੰਘੇ ਸਾਹ ਲਈਏ ਡੂੰਘੀ ਯੋਗਾ ਕਰੀਏ ਡੂੰਘੇ ਸਾਹ ਲੈ ਕੇ ਪਰਾਣਾਯਾਮ ਕਰੀਏ ਕਪਾਲਭਾਤੀ ਜਿਹਨੂੰ ਕਿਹਾ ਜਾਂਦਾ ਹੈ ਅਤੇ ਉਹਦੇ ਨਾਲ ਸਾਡਾ ਸਰੀਰ ਹੋਰ ਤੰਦਰੁਸਤ ਹੁੰਦਾ ਹੈ ਇਹਦੀ ਸਾਡੇ ਲਈ ਬਹੁਤ ਮਹੱਤਵਪੂਰਨ ਭੂਮਿਕਾ ਹੈ ਇਸ ਯੋਗਾ ਅਭਿਆਸ ਦੀ ਸਾਡੇ ਸਰੀਰ ਦੇ ਵਿੱਚ